ਜੀ ਹਾਂ ਸਾਡੀ ਰੋਜ਼ੀ ਰੋਟੀ ਬਿਲਕੁਲ ਬਿਜਲੀ 'ਤੇ ਨਿਰਭਰ ਕਰਦੀ ਹੈ ਬਿਜਲੀ ਤੋਂ ਬਿਨਾਂ ਕੋਈ ਕੰਮ ਵੀ ਨਹੀਂ ਹੋ ਸਕਦਾ ਅੱਜ ਦੀ ਤਰੀਕ 'ਚ ਆਧੁਨਿਕ ਸਮਾਂ ਹੈ ਡਿਜੀਟਲ ਸਮਾਂ ਹੈ ਡਿਜੀਟਲ ਸਮੇਂ ਵਿੱਚ ਬਿਜਲੀ ਤੋਂ ਬਿਨਾਂ ਅਸੀਂ ਕੁਛ ਸੋਚ ਵੀ ਨਹੀਂ ਸਕਦੇ ਲੇਕਿਨ ਹਾਂ ਬਿਜਲੀ ਦਾ ਜਦੋਂ ਵੀ ਕੱਟ ਲੱਗਦਾ ਹੈ ਤਾਂ ਅਸੀਂ ਉਸ ਟਾਈਮ 'ਤੇ ਇਨ ਇਨਵਰਟਰ ਦਾ ਯੂਸ ਕਰ ਸਕਦੇ ਹਾਂ ਸਾਡੇ ਕੋਲ ਸਭ ਕੋਲ ਅੋਲਮੋਸਟ ਮਿਡਲ ਕਲਾਸ ਲੋਕਾਂ ਕੋਲ ਹੁੰਦਾ ਹੈ ਇਨਵਰਟਰ ਅਤੇ ਇਹਦਾ ਵਿਕਲਪ ਹੈ ਇੱਕ ਮ ਇਨਵਰਟਰ ਜਾਂ ਜੇ ਜਿਸ ਤਰ੍ਹਾਂ ਵੱਡੀਆਂ ਵੱਡੀਆਂ ਕੰਪਨੀਜ਼ ਨੇ ਅਤੇ ਉਹਨਾਂ ਕੋਲ ਵੀ ਇਨਵਰਟਰ ਹੁੰਦੇ ਨੇ ਉਹਨਾਂ ਕੋਲ ਹੋਰ ਸਿਸਟਮ ਹੁੰਦੇ ਨੇ ਜਿਨ੍ਹਾਂ 'ਚੋਂ ਉਹ ਆਪਣਾ ਬਿਜਲੀ ਦਾ ਵਿਕਲਪ ਯੂਸ ਕਰਦੇ ਨੇ ਅਤੇ ਪ੍ਰਭਾਵਿਤ ਬਿਲਕੁਲ ਹੁੰਦੀ ਹੈ ਜੇ ਲੰਬੇ ਸਮੇਂ ਲਈ ਚਲੀ ਜਾਵੇ ਤਾਂ ਬਿਲਕੁਲ ਪ੍ਰਭਾਵਿਤ ਹੋਏਗੀ ਥੋੜ੍ਹੇ ਦੇਰ ਲਈ ਤਾਂ ਇਨਵਰਟਰ ਕੱਟਵਾ ਦਿੰਦੇ ਨੇ ਟਾਈਮ ਬਿਲਕੁਲ ਸਮਾਂ ਘਟਾ ਦਿੰਦੇ ਨੇ ਲੇਕਿਨ ਜੇ ਬਿਜਲੀ ਦੇ ਕੱਟ ਬਹੁਤ ਲੰਬੇ ਹੋ ਜਾਣ ਤਾਂ ਕੰਮ 'ਤੇ ਬਿਲਕੁਲ ਅਸਰ ਪੈਂਦਾ ਹੈ ਕਿਉਂਕਿ ਅੱਜ ਕੱਲ੍ਹ ਆਧੁਨਿਕ ਸਮੇਂ 'ਚ ਹਰ ਕੋਈ ਮੋਬਾਇਲ 'ਤੇ ਫੋਨ 'ਤੇ ਡਿਪੈਂਡੈਂਟ ਹੈ ਆਪਣਾ ਅਤੇ ਸਾਡਾ ਸਾਰਾ ਕੰਮ ਅੱਜ ਕੱਲ੍ਹ ਕੰਪਿਊਟਰਸ ਅਤੇ ਲੈਪਟੋਪਸ 'ਤੇ ਹੁੰਦਾ ਹੈ ਅਤੇ ਵਾਈਫਾਈਸ ਦੀ ਵੀ ਸਭ ਕੁਛ ਚਲਦਾ ਹੀ ਬਿਜਲੀ 'ਤੇ ਹੈ ਅਤੇ ਜ ਜਿੰਨੀ ਜਿਹੜੀ ਚੀਜ਼ਾਂ ਦਾ ਕਨੈਕਸ਼ਨ ਅਸੀਂ ਇਨਵਰਟਰ ਨਾਲ ਕਰਵਾ ਲੈਂਦੇ ਉਹ ਚੱਲ ਪੈਂਦਾ ਹੈ ਪਰ ਇਨਵਰਟਰ ਵੀ ਇੱਕ ਆਫਟਰ ਅੋਲ ਥੋੜ੍ਹੀ ਚੀਜ਼ ਛੋਟੀ ਹੈ ਉਹ ਵੀ ਥੋੜ੍ਹੀ ਘੰਟਿਆਂ ਹੀ ਕੰਮ ਕਰਦੀ ਹੈ ਜੇ ਹੁਣ ਇੱਕ ਬਿਜਲੀ ਦਾ ਕੱਟ ਦੋ ਦੋ ਦਿਨ ਲੱਗ ਜਾਵੇਗਾ ਤਾਂ ਫੇਰ ਇਨਵਰਟਰ ਵੀ ਕੁਛ ਨਹੀਂ ਕਰ ਸਕਦਾ ਹੈ